ਨਿਜੀ ਬੈਂਕ ਨਾਲ ਜੇ ਦੱਸਿਆ ਜਾਵੇ ਤਾਂ ਮੇਰਾ ਨਜਿੱਠਣ ਦਾ ਤਰੀਕਾ ਬਹੁਤ ਤਜ਼ਰਬਾ ਮੇਰਾ ਬਹੁਤ ਹੀ ਵੱਖਰਾ ਰਿਹਾ ਆਮਤੌਰ ਦੇਖਿਆ ਜਾਂਦਾ ਹੈ ਕਿ ਲੋਕਾਂ ਨੂੰ ਸਰਕਾਰੀ ਬੈਂਕ ਜ਼ਿਆਦਾ ਪਸੰਦ ਨੇ ਪਰ ਮੈਂ ਆਪਣੇ ਨਿੱਜੀ ਐਕਸਪੀਰੀਅਸ ਦੇ ਨਾਲ ਅਨੁਭਵ ਦੇ ਨਾਲ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਨਿਜੀ ਬੈਂਕ ਦੇ ਨਾਲ ਬਹੁਤ ਹੀ ਵਧੀਆ ਤਜ਼ਰਬਾ ਰਿਹਾ ਹੈ ਮੈਂ ਜਿੰਨੀ ਵਾਰ ਵੀ ਅੱਜ ਤੱਕ ਵੈਸੇ ਤਾਂ ਮੇਰੇ ਬਹੁਤੇ ਅਕਾਊਂਟ ਨਹੀਂ ਹਨ ਮੇਰਾ ਸਿਰਫ਼ ਇੱਕੋ ਹੀ ਅਕਾਊਂਟ ਹੈ ਜਿਹੜਾ ਕਿ ਮੈਂ ਹੀ ਚਲਾਉਂਦੀ ਹਾਂ ਅਤੇ ਅਗਰ ਜੇ ਕਿਸੇ ਤਰ੍ਹਾਂ ਦੇ ਵੀ ਕੋਈ ਸਰਕਾਰੀ ਬੈਂਕ ਦੇ ਵਿੱਚ ਕੋਈ ਖਾਤਾ ਹੈ ਤਾਂ ਉਹ ਮੇਰੇ ਪਤੀ ਹੀ ਉਸਨੂੰ ਚਲਾਉਂਦੇ ਨੇ ਅਤੇ ਜਿੱਥੇ ਤੱਕਰ ਇਹ ਗੱਲ ਨਿੱਜੀ ਬੈਂਕ ਦੀ ਮੈਨੂੰ ਲੋੜ ਪੈਣ ਦੇ ਉੱਤੇ ਮੇਰੀ ਸਹਾਇਤਾ ਕੀਤੀ ਅਤੇ ਬਿਲਕੁਲ ਮੈਨੂੰ ਅਗਰ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਐ ਤਾਂ ਜਿਹੜੀਆਂ ਅੱਜ ਕੱਲ੍ਹ ਆਨਲਾਈਨ ਐਪਸ ਚਲੀਆਂ ਹੋਈਆਂ ਨੇ ਉਹ ਸਭ ਤੋਂ ਵਧੀਆ ਜਿਹੜੀ ਹੈ ਉਹ ਮੈਨੂੰ ਨਿੱਜੀ ਬੈਂਕਾਂ ਦੀ ਲੱਗਦੀ ਹੈ ਤੁਸੀਂ ਘਰ ਬੈਠੇ ਕਿਤੇ ਵੀ ਬੈਠੇ ਅਗਰ ਮੈਂ ਬੈਂਕ ਨਹੀਂ ਜਾ ਸਕਦੀ ਤਾਂ ਮੈਂ ਆਨਲਾਈਨ ਉਸ ਐਪ ਨੂੰ ਚਲਾ ਕੇ ਆਪਣੇ ਜਿਹੜੇ ਪੈਸੇ ਦਾ ਲੈਣ ਦੇਣ ਕਰ ਲੈਂਦੀ ਹਾਂ ਅਤੇ ਅਗਰ ਕਿਸੇ ਤਰ੍ਹਾਂ ਦੀ ਵੀ ਮੈਨੂੰ ਮੇਰੀ ਐਪ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਤਾਂ ਉਹਦੇ ਵਾਸਤੇ ਵੀ ਮੈਂ ਬੈਂਕ ਇੱਕ ਕਾਲ ਹੀ ਕਰਦੀ ਹਾਂ ਸਿਰਫ਼ ਇੱਕ ਫੋਨ ਦੇ ਨਾਲ ਮੇਰੀ ਜਿਹੜੀ ਮੁਸੀਬਤ ਹੁੰਦੀ ਹੈ ਉਸਦਾ ਹੱਲ ਕਰ ਦਿੱਤਾ ਜਾਂਦਾ ਹੈ ਮੇਰੀ ਬਹੁਤ ਹੀ ਸਹਾਇਤਾ ਹੁੰਦੀ ਹੈ ਔਰ ਨਿੱਜੀ ਬੈਂਕ ਜੇ ਮੈਨੂੰ ਕੋਈ ਵੀ ਕਹਿੰਦਾ ਹੈ ਕਿ ਅਕਾਊਂਟ ਕਿਸ ਬੈਂਕ ਦੇ ਵਿੱਚ ਖੁਲਵਾਇਆ ਜਾਵੇ ਤਾਂ ਮੈਂ ਹਮੇਸ਼ਾ ਹੀ ਨਿੱਜੀ ਬੈਂਕ ਦੀ ਹੀ ਉਸਨੂੰ ਕਹਾਂਗੀ ਧੰਨਵਾਦ